ਸ਼ਹਿਰ ਸ਼ਹਿਰ ਦੀ ਬਜਾਏ ਪਿੰਡ ਜ਼ਿਆਦਾ ਵਧੀਆ ਹਨ ਕਿਉਂਕਿ ਸ਼ਹਿਰਾਂ ਵਿੱਚ ਇੱਕ ਤਾਂ ਪ੍ਰਦੂਸ਼ਣ ਬਹੁਤ ਹੈ ਵਹੀਕਲ ਬਹੁਤ ਚੱਲਦੇ ਹਨ ਉਹਨਾਂ ਦੇ ਕਰਕੇ ਪ੍ਰਦੂਸ਼ਣ ਹੋ ਜਾਂਦਾ ਅਤੇ ਉਹਨਾਂ ਦੇ ਕਰਕੇ ਆਪਣੀ ਵਾਤਾਵਰਨ ਸਾਫ਼ ਸੁਥਰਾ ਨਹੀਂ ਰਹਿੰਦਾ ਪਿੰਡਾਂ ਵਿੱਚ ਪੇੜ ਪੌਦੇ ਅਤੇ ਦਰੱਖਤ ਬਹੁਤ ਹੁੰਦੇ ਹਨ ਆਲੇ ਦੁਆਲੇ ਖੇਤ ਹੁੰਦੇ ਆ ਉਹਨਾਂ ਦੇ ਕਰਕੇ ਇੱਕ ਤਾਂ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਆਪਣੇ ਵਾਸਤੇ ਸਿਹਤ ਵਾਸਤੇ ਫ਼ਾਇਦੇਮੰਦ ਹੈਗੀ ਹੈ ਆਕਸੀਜਨ ਆਪਣੇ ਵਾਸਤੇ ਬਹੁਤ ਫ਼ਾਇਦੇਮੰਦ ਹੈ ਇੱਕ ਖੁੱਲ੍ਹਾ ਸਾਰਾ ਕੁਛ ਬਣਿਆ ਹੁੰਦਾ ਹੈਗਾ ਉਹਦੇ 'ਚ ਪਿੰਡਾਂ ਵਿੱਚ ਪੇੜ ਪੌਦੇ ਹੁੰਦੇ ਆ ਹ ਹਰਿਆਲੀ ਬਹੁਤ ਹੁੰਦੀ ਹੈ ਪਿੰਡਾਂ ਵਿੱਚ ਸਾਰਾ ਕੁਛ ਖੁੱਲ੍ਹਾ ਬਣਿਆ ਹੁੰਦਾ ਉਹਨਾਂ ਦੇ ਵਾਸਤੇ ਆਪਾਂ ਨੂੰ ਨਾ ਇਹ ਵੀ ਵਧੀਆ ਰਹਿੰਦਾ ਹੈ ਪਿੰਡਾਂ ਦਾ ਮਾਹੌਲ ਸ਼ਹਿਰਾਂ ਵਿੱਚ ਭੋਜਨ ਵਿੱਚ ਕੈਮੀਕਲ ਵੀ ਬਹੁਤ ਜ਼ਿਆਦਾ ਹੁੰਦ ਹੈ ਹੁੰਦੇ ਹੈ ਜਿਹੜੇ ਆਪਣੀ ਸਿਹਤ ਵਾਸਤੇ ਵਧੀਆ ਨਹੀਂ ਹੁੰਦੇ ਹੈਗੇ ਸ਼ਹਿਰਾਂ ਸ਼ਹਿਰਾਂ ਦੇ ਲੋਕ ਬਾਜ਼ਾਰ ਦਾ ਖਾਣਾ ਖਾਂਦੇ ਹੈ ਜਿਹੜਾ ਸਾਫ਼ ਸੁਥਰਾ ਨਹੀਂ ਹੁੰਦਾ ਪਿ ਪਰ ਪਿੰਡਾਂ ਦੇ ਲੋਕ ਜ਼ਿਆਦਾਤਰ ਘਰ ਦਾ ਭੋਜਨ ਪਸੰਦ ਕਰਦੇ ਹਨ ਉਹਨਾਂ ਦਾ ਸਾਦਾ ਭੋਜਨ ਉਹ ਸਾਦਾ ਭੋਜਨ ਜ਼ਿਆਦਾ ਪਸੰਦ ਕਰਦੇ ਹਨ ਪਿੰਡਾਂ ਦੇ ਲੋਕ ਆਪਣੇ ਹੱਥ ਨਾਲ ਬਣਾ ਕੇ ਸਾਫ਼ ਸੁਥਰਾ ਖਾਣਾ ਜਿਹੜਾ ਆਪਣੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈਗਾ ਅਤੇ ਨਾਲੇ ਉਸ ਜਿਹੜਾ ਆਪਾਂ ਆਪਣੇ ਹੱਥ ਨਾਲ ਬਣਾਉਂਦੇ ਹਾਂ ਉਹ ਦਿਲ ਨੂੰ ਤਸੱਲੀ ਵੀ ਦਿੰਦਾ ਹੈ ਸਾਫ਼ ਸੁਥਰਾ ਹੁੰਦਾ ਹੈਗਾ ਜਿਹੜਾ ਸ਼ਹਿਰਾਂ ਵਿੱਚ ਹੁੰਦਾ ਉਹ ਬਜ਼ਾਰੀ ਖਾਣਾ ਉਹ ਸਾਫ਼ ਸੁਥਰਾ ਨਹੀਂ ਹੁੰਦਾ ਹੈਗਾ ਉਹਦੇ ਨਾਲ ਤਾਂ ਹੀ ਤਾਂ ਸ਼ਹਿਰਾਂ ਦੇ ਲੋਕਾਂ ਨੂੰ ਜ਼ਿਆਦਾ ਬਿਮਾਰੀਆਂ ਲੱਗਦੀਆਂ ਹਨ ਪਿੰਡਾਂ ਦੇ ਪਿੰਡਾਂ ਵਿੱਚ ਅਭਿਆਸ ਕਰਨ ਵਾਸਤੇ ਪਿੰਡਾਂ ਦਾ ਮਾਹੌਲ ਵਧੀਆ ਹੈਗਾ ਕਿਉਂਕਿ ਇੱਥੇ ਆਕਸੀਜਨ ਵੀ ਬਹੁਤ ਵਧੀ ਹੁੰਦੀ ਹੈਗੀ ਹੈ ਅਤੇ ਮਾਹੌਲ ਵੀ ਵਧੀਆ ਹੁੰਦਾ ਹੈਗਾ